ਹਾਂਜੀ ਮੈਨੂੰ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦਾ ਸ਼ੌਂਕ ਹੈ ਮੈਂ ਨਾ ਹੱਥੀ ਬਹੁਤ ਸਾਰੀਆਂ ਚੀਜ਼ਾਂ ਬਣਾਉਂਦਾ ਗਾ ਜਿਵੇਂ ਕਿ ਕੰਮ ਕਾਰ ਦੀ ਗੱਲ ਕਰ ਲਓ ਆਪਾਂ ਧਲਿਆਰਾ ਬਣਾਉਣਾ ਗਾ ਹੈ ਨਾ ਪਸ਼ੂਆਂ ਦੇ ਦ ਬੰਨਣ ਵਾਲਾ ਧਲਿਆਰਾ ਬੋਲਦੇ ਹਾਂ ਅਸੀਂ ਇੱਧਰ ਪੰਜਾਬ ਦੇ ਵਿੱਚ ਤਾਂ ਉਹ ਮੈਂ ਕਿੰਨੇ ਲੋਕਾਂ ਨੂੰ ਬਣਾ ਕੇ ਦਿੱਤਾ ਹੈਗਾ ਚਲੋ ਸ਼ਿੱਕਲੀ ਹੁੰਦੀ ਹੈ ਛੋਟੇ ਕੱਟਰੂੰਆਂ ਦੇ ਉੱਪਰ ਸ਼ਿੱਕਲੀ ਚੜ੍ਹਾਈ ਜਾਂਦੀ ਹੈ ਉਹਨੂੰ ਵੀ ਮੈਂ ਪਤਾ ਨਹੀਂ ਮੈਂ ਕਿੰਨੀਆਂ ਕੁ ਸ਼ਿੱਕਲੀਆਂ ਬਣਾ ਤੀਆਂ ਅਤੇ ਮੈਂ ਲੋਕਾਂ ਨੂੰ ਵੰਡਤੀਆ ਨਿਆਣਾ ਬਟਨਾ ਇਹ ਸਾਰੇ ਕੰਮ ਜਿਹੜੇ ਮੈਂ ਪੂਰੇ ਵਧੀਆ ਢੰਗ ਦੇ ਨਾਲ ਕਰਦਾ ਹੈਗਾ ਇਸ ਤੋਂ ਇਲਾਵਾ ਮੈਨੂੰ ਮਿੱਟੀ ਦੇ ਮੈਂ ਖਿਡੌਣੇ ਬਹੁਤ ਵਧੀਆ ਬਣਾਉਂਦਾ ਮੂਰਤੀ ਬਣਾ ਦਿੰਦਾ ਇੱਕ ਵਾਰ ਨਾ ਮੈਂ ਗਣੇਸ਼ ਦੀ ਮੂਰਤੀ ਬਣਾਈ ਬਹੁਤ ਵਧੀਆ ਇੰਨੀ ਘੈਂਟ ਮੂਰਤੀ ਬਣੀ ਤੋ ਜਿਹੜਾ ਕਿ ਮੇਰੇ ਨਾਨਕਿਆਂ ਤੋਂ ਆਏ ਸੀ ਮੇਰੇ ਮਾਮੇ ਦਾ ਮੁੰਡਾ ਉਹਨੂੰ ਮੂਰਤੀ ਇੰਨੀ ਪਸੰਦ ਆ ਗਈ ਉਹ ਨਾ ਲੈ ਗਿਆ ਕਹਿੰਦਾ ਜਾ ਤਾਂ ਬਾਈ ਮੈਨੂੰ ਹੋਰ ਮੂਰਤੀ ਬਣਾ ਦੇ ਇਹ ਜਿਹੀ ਹੁਣੇ ਹੁਣੇ ਨਹੀਂ ਮੈਂ ਤਾਂ ਇਹ ਹੀ ਲੈ ਕੇ ਜਾਊਂ ਮੈਂ ਕਿਹਾ ਯਾਰ ਤੂੰ ਕੇਰਾਂ ਇਹ ਹੀ ਲੈ ਜਾ ਅਸੀਂ ਆਪਣੇ ਵਾਸਤੇ ਹੋਰ ਬਣਾ ਲਾਂਗੇ ਮਿੱਟੀ ਦੀਆਂ ਮੂਰਤੀਆਂ ਤਾਂ ਮੈਂ ਬਣਾ ਹੀ ਲੈਣਾ ਬਹੁਤ ਵਧੀਆ ਬਣਾਉਂਦਾ ਹੈਗਾ ਅਤੇ ਉਸ ਤੋਂ ਇਲਾਵਾ ਜਿਹੜੇ ਮੈਂ ਤੁਹਾਨੂੰ ਦੱਸਿਆ ਪਸ਼ੂਆਂ ਦੇ ਜਿਵੇਂ ਧਲਿਆਰੇ ਹੋ ਗਏ ਸ਼ਿੱਕਲੀਆਂ ਨਿਆਣਾ ਵੱਟਣਾ ਹੈਨਾ ਉਹਨਾਂ ਦੇ ਪੀਲਾ ਬੰਨਣੀਆਂ ਵੱਟ ਕੇ ਇਹੋ ਜਿਹੇ ਕੰਮ ਵੀ ਆਪਾਂ ਵਾਧੂ ਕਰੀਦੇ ਹੈਗੇ ਪਰ ਜਿਹੜਾ ਕਿ ਇਹ ਜਿਵੇਂ ਇਹ 'ਚ ਤੁਸੀਂ ਮੂਰਤੀ ਦੀ ਗੱਲ ਕੀਤੀ ਹੈ ਮੂਰਤੀ ਦੀ ਗੱਲ ਆਪਾਂ ਨਹੀਂ ਹੋਵੇਗੀ ਮੈਂ ਗਣੇਸ਼ ਦੀ ਮੂਰਤੀ ਬਹੁਤ ਵਧੀਆ ਬਣਾ ਲੈਂਦਾ ਹਾਥੀ ਘੋੜੇ ਬਲਦ ਆਦਮੀ ਔਰਤ ਇਹ ਸਾਰੀਆਂ ਚੀਜ਼ਾਂ ਮਿੱਟੀ ਦੀਆਂ ਬਹੁਤ ਵਧੀਆ ਢੰਗ ਦੇ ਨਾਲ ਬਣਾਉਂਦਾ ਹੈਗਾ ਮੈਂ ਕਿਉਂਕਿ ਅਭਿਆਸ ਕਰਨ ਦੇ ਨਾਲ ਹੀ ਹੈ ਜਿਵੇਂ ਸ਼ੁਰੂ ਤੋਂ ਸ਼ੌਂਕ ਹੈਗਾ ਮੈਂ ਉਦੋਂ ਦਾ ਕਰਦਾ ਆ ਰਿਹਾ ਅਤੇ ਉੰਨੀਆ ਚੀਜ਼ਾਂ ਦੇ ਵਿੱਚ ਹੀ ਮੈਂ ਪਰਫੈਕਟ ਹੋਈ ਜਾਂਦਾ ਹੈਗਾ ਹਾਂਜੀ ਹਾਂਜੀ ਓਕੇ ਜੀ ਧੰਨਵਾਦ